ਕਾਰੋਬਾਰ ਦੇ ਵਿੱਚ ਤਕਨੀਕ ਦਾ ਹੋਣਾ ਬਹੁਤ ਜ਼ਰੂਰੀ ਹੈ ਤਕਨੀਕ ਦੇ ਜ਼ਰੀਏ ਹੀ ਅਸੀਂ ਕਾਰੋਬਾਰ ਨੂੰ ਅੱਗੇ ਵਧਾ ਸਕਦੇ ਹਾਂ ਫਾਸਟਲੀ ਤਕਨੀਕ ਹੀ ਹੈ ਜਿਸ ਦੇ ਕਾਰਨ ਅਸੀਂ ਕੋਈ ਵੀ ਕੰਮ ਸ਼ੁਰੂ ਕਰਨਾ ਜੇ ਸਾਨੂੰ ਉਸਦੀ ਤਕਨੀਕ ਨਹੀਂ ਹੈ ਤਾਂ ਅਸੀਂ ਅੱਗੇ ਨਹੀਂ ਵਧ ਸਕਦੇ ਦੂਜੇ ਨੰਬਰ 'ਤੇ ਪੈਸਾ ਆਉਂਦਾ ਹੈ ਅਤੇ ਆਦਮੀਆਂ ਦੀ ਜ਼ਰੂਰਤ ਹੁੰਦੀ ਹੈ ਪਰ ਪਹਿਲਾ ਕੰਮ ਤਕਨੀਕ ਹੀ ਹੈ ਜਿਸ ਦੇ ਜ਼ਰੀਏ ਅਸੀਂ ਜੀਹਨਾ ਕਾਰੋਬਾਰ ਨੂੰ ਵਧਾਇਆ ਜਾ ਸਕਦਾ ਹੈ